ਸੌਲਾਂ ਫਰਵਰੀ ਦੋ ਹਜ਼ਾਰ ਅੱਠ ਸੱਤ ਜੁਲਾਈ ਉੱਨੀ ਸੌ ਇਕਿਆਸੀ ਸਤਾਈ ਜੁਲਾਈ ਦੋ ਹਜ਼ਾਰ ਇੱਕ ਇੱਕੀ ਜੂਨ ਉੱਨੀ ਸੌ ਇਕਿਆਸੀ ਅਠਾਈ ਸਤੰਬਰ ਉੱਨੀ ਸੌ ਅੱਠਵੰਜਾ